ਮੈਂ ਲੰਬੀ ਬਾਈਕਿੰਗ ਯਾਤਰਾ ਜਾਂ ਟੂਰ ਲਈ ਇਸ ਲਈ ਤਿਆਰ ਹਾਂ ਕਿਉਂਕਿ ਇਸ ਦੇ ਨਾਲ ਫਿਟਨੈਸ ਬਣੀ ਰਹਿੰਦੀ ਹੈ ਅਤੇ ਦੋਸਤਾਂ ਦੇ ਨਾਲ ਜਾਣ ਵਿੱਚ ਹੋਰ ਵੀ ਮਜ਼ਾ ਆਉਂਦਾ ਹੈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਜੋ ਅਸੀਂ ਆਪਣੇ ਨਾਲ ਲੈ ਕੇ ਜਾਣੀਆਂ ਹੁੰਦੀਆਂ ਹਨ ਜਿਵੇਂ ਕਿ ਅਸੀਂ ਨਾਲ ਪਾਣੀ ਲੈ ਕੇ ਜਾਣਾ ਹੁੰਦਾ ਹੈ ਉਸ ਦੇ ਵਿੱਚ ਜੇ ਅਸੀਂ ਗਰਮੀ ਵਿੱਚ ਟੂਰ ਲਈ ਜਾ ਰਹੇ ਹਾਂ ਤਾਂ ਉਸ ਵਿੱਚ ਗਲੂਕੋਨ ਡੀ ਪਾ ਸਕਦੇ ਹਾਂ ਜਿਸ ਦੇ ਨਾਲ ਸਾਨੂੰ ਐਨਰਜੀ ਮਿਲਦੀ ਹੈ ਉਸ ਤੋਂ ਇਲਾਵਾ ਸਾਨੂੰ ਨਾਲ ਦਵਾਈਆਂ ਲੈ ਕੇ ਜਾਣੀਆਂ ਚਾਹੀਦੀਆਂ ਹਨ ਜੇਕਰ ਕੋਈ ਵੀ ਸਾਡੇ ਪੇਟ ਦਰਦ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਸਾਨੂੰ ਪਰੇਸ਼ਾਨੀ ਆਉਂਦੀ ਹੈ ਤਾਂ ਸਾਡੇ ਕੋਲ ਦਵਾਈ ਹੋਣੀ ਚਾਹੀਦੀ ਹੈ ਜਾਂ ਫਸਟ ਐਡ ਕਿੱਟ ਸਾਡੇ ਕੋਲ ਹੋਣੀ ਚਾਹੀਦੀ ਹੈ ਜੇ ਸਾਡੇ ਸੱਟ ਲੱਗ ਜਾਏ ਤਾਂ ਬੈਡਡ ਪੱਟੀ ਦਵਾਈ ਸਾਡੇ ਕੋਲ ਇਹੋ ਜਿਹੀਆਂ ਚੀਜ਼ਾਂ ਉਪਲਬਧ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਰਸਤੇ ਵਿੱਚ ਕਈ ਵਾਰੀ ਚੀਜ਼ਾਂ ਇਹ ਸਾਨੂੰ ਆਸਾਨੀ ਨਾਲ ਨਹੀਂ ਮਿਲਦੀਆਂ ਅਤੇ ਜੇਕਰ ਇਹ ਸਾਡੇ ਕੋਲ ਹੋਣਗੀਆਂ ਤਾਂ ਇਸ ਨਾਲ ਸਾਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ